ਸਤਿ ਸ਼੍ਰੀ ਅਕਾਲ ਸਰ ਜੀ ਹਾਂ ਸਰ ਜੀ ਮਲਕੀ ਅਸੀਂ ਖਾਣਾ ਬਣਾਉਂਦੇ ਹਾਂ ਚੁੱਲ੍ਹੇ 'ਤੇ ਹਾਂ ਮਜੇ ਨਾਲ ਬਣਾਉਂਦੇ ਹਾਂ ਚੁੱਲ੍ਹੇ 'ਤੇ ਖਾਣਾ ਸਾਨੂੰ ਚੁੱਲ੍ਹੇ 'ਤੇ ਬਣਾਉਣਾ ਬਹੁਤ ਪਸੰਦ ਹੈ ਹਾਂ ਲੱਕੜੀਆਂ ਗੋਟੇ ਨਾਲ ਬਾਲ ਕੇ ਚੁੱਲ੍ਹੇ 'ਤੇ ਖਾਣਾ ਬਣਾਉਂਦੇ ਹਾਂ ਰਾਜਮਾਂਹ ਚਾਵਲ ਜਿੱਦਾਂ ਕੋਈ ਵੀ ਚੀਜ਼ ਹੈ ਚੁੱਲ੍ਹੇ ਦਾ ਖਾਣਾ ਬਹੁਤ ਪਸੰਦ ਕਰਦੇ ਹੈ ਹਾਂਜੀ ਮੇਰੇ ਪਰਿਵਾਰ ਵਾਲੇ ਵੀ ਬਹੁਤ ਪਸੰਦ ਕਰਦੇ ਆ ਚੁੱਲ੍ਹੇ ਦਾ ਖਾਣਾ ਜੀ ਬਾਕੀ ਉਹਦੇ ਨਾਲ ਚੁੱਲ੍ਹੇ ਦੇ ਚੁੱਲ੍ਹੇ ਦੀ ਰੋਟੀ ਨਾਲ ਗੈਸ ਨਹੀਂ ਹੁੰਦੀ ਇੱਕ ਤਾਂ ਸਵਾਦ ਵੀ ਹੁੰਦੀ ਹੈ ਅਤੇ ਚੁੱਲ੍ਹੇ ਦੇ ਮਲਕੀ ਟਾਈਮ ਤੁਹਾਡਾ ਲੱਗ ਜਾਂਦਾ ਆ ਅਤੇ ਦਾਲ ਚਾਵਲ ਬਣਾਉਣੇ ਹੋਣ ਤਾਂ ਘੱਟ ਟਾਈਮ ਲੱਗਦਾ ਆ ਰਾਜਮਾਂਹ ਚਾਵਲ ਬਣਾਉਣੇ ਆ ਥੋੜ੍ਹਾ ਜ਼ਿਆਦਾ ਟਾਈਮ ਲੱਗ ਜਾਂਦਾ ਆ ਹਾਂ ਰਾਜਮਾਂਹ ਚਾਵਲ ਬਣਾਓ ਫੁਲਕਾ ਬਣਾਓ ਨਾਲ ਸਬਜ਼ੀ ਬਣਾਓ ਥੋੜ੍ਹਾ ਜ਼ਿਆਦਾ ਟਾਈਮ ਲੱਗ ਜਾਂਦਾ ਘੰਟਾ ਡੇਢ ਘੰਟਾ ਲੱਗ ਜਾਂਦਾ ਆ ਦੋ ਚਾਰ ਚੀਜ਼ਾਂ ਬਣਾਉਣੀਆ ਹੋਣ ਤਾਂ ਅਤੇ ਮੇਰੇ ਪਰਿਵਾਰ ਵਾਲੇ ਚੁੱਲ੍ਹੇ ਦਾ ਮਲਕੀ ਚੁੱਲ੍ਹੇ ਦੀ ਰੋਟੀ ਬੜੀ ਪਸੰਦ ਕਰਕੇ ਖਾਂਦੇ ਆ ਅਤੇ ਇੱਕ ਸਿਹਤ ਲਈ ਮਲਕੀ ਠੀਕ ਹੁੰਦੀ ਆ ਚੁੱਲ੍ਹੇ ਦੀ ਰੋਟੀ ਸਿਹਤ ਲਈ ਠੀਕ ਹੁੰਦੀ ਹੈ ਅਤੇ ਚੁੱਲ੍ਹੇ ਦੀ ਰੋਟੀ ਮਲਕੀ ਖਾਣ ਨਾਲ ਮਲਕੀ ਸਿਹਤ ਵੀ ਠੀਕ ਰਹਿੰਦੀ ਆ ਇਕ ਗੈਸ ਨਹੀਂ ਹੁੰਦੀ ਅਤੇ ਚੁੱਲੇ 'ਤੇ ਅਸੀਂ ਕੁਛ ਵੀ ਬਣਾ ਸਕਦੇ ਹਾਂ ਅੱਗ ਬਾਲ ਕੇ ਅਤੇ ਮਲਕੀ ਗੈਸ ਵਾਲੀ ਚੀਜ਼ ਜਿਹੜੀ ਆ ਗੈਸ ਦੀ ਚੀਜ਼ ਮਲਕੀ ਖ਼ਰਾਬ ਲੱਗਦੀ ਆ ਚੁੱਲ੍ਹੇ ਦੀ ਚੀਜ਼ ਖ਼ਰਾਬ ਨਹੀਂ ਲੱਗਦੀ ਅਤੇ ਚੁੱਲ੍ਹੇ ਦੀ ਰੋਟੀ ਬੜੀ ਸਵਾਦ ਲੱਗਦੀ ਹੈ ਰਾਜਮਾਂਹ ਚਾਵਲ ਬਣਾ ਲੈਂਦੇ ਹਾਂ ਘੰਟਾ ਡੇਢ ਘੰਟਾ ਲੱਗ ਜਾਂਦਾ ਆ ਦਾਲ ਚਾਵਲ ਬਣਾ ਲੈਂਦੇ ਹਾਂ ਫੁਲਕਾ ਬਣਾ ਲੈਂਦੇ ਹਾਂ ਮਲਕੀ ਹਰ ਚੀਜ਼ ਅਸੀਂ ਮਲਕੀ ਅੱਗ ਬਾਲ ਕੇ ਚੁੱਲੇ 'ਤੇ ਹੀ ਬਣਾਉਂਦੇ ਹਾਂ ਅਤੇ ਸਵਾਦ ਵੀ ਲੱਗਦੀ ਆ ਪਰਿਵਾਰ ਵਾਲੇ ਬਹੁਤ ਖੁਸ਼ ਹੋ ਕੇ ਖਾਂਦੇ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਹੈ ਅਤੇ ਮੈਨੂੰ ਬੜਾ ਪਸੰਦ ਹੈ ਚੁੱਲ੍ਹੇ ਦੀ ਰੋਟੀ ਬਣਾਉਣਾ ਅਤੇ ਮੈਂ ਬੜੇ ਚਾਅ ਨਾਲ ਚੁੱਲ੍ਹੇ 'ਤੇ ਰੋਟੀ ਬਣਾਉਂਦੀ ਹਾਂ ਹਾਂਜੀ ਸਰ ਜੀ ਠੀਕ ਹੈ